ਕੁਰਾਲੀ ਸ਼ੀਤਲਾ ਮਾਤਾ ਦੇ ਮੰਦਰ ਅੰਦਰ ਸਾਲ ਵਿੱਚ ਇੱਕ ਵਾਰੀ ਮੇਲਾ ਭਰਦਾ ਹੈ ਜਿੱਥੇ ਕਿ ਗੁਲਗੁਲੇ ਅਤੇ ਕਚੋਰੀਆਂ ਆਦਿ ਦੇ ਨਾਲ ਲੋਕ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਦੇ ਹਨ ਹਰ ਘਰ ਦੇ ਵਿੱਚ ਇਹ ਚੀਜ਼ਾਂ ਬਣਾ ਕੇ ਖਾਈਆਂ ਜਾਂਦੀਆਂ ਹਨ ਵਰਤੀਆਂ ਜਾਂਦੀਆਂ ਹਨ